ਹਾਂ ਮੈਂ ਨਾ ਕੁਛ ਦਿਨ ਪਹਿਲਾਂ ਅ ਮਾਈਕਰੋਵੇਵ ਖਰੀਦਿਆ ਜੋ ਕਿ ਮੈਨੂੰ ਬੜਾ ਸਸਤਾ ਮਿਲ ਗਿਆ ਆਨਲਾਈਨ ਮੈਂ ਸ਼ੋਪਿੰਗ ਕੀਤੀ ਸੀ ਕਿਉਂਕਿ ਫੈਸਟੀਵਲ ਚੱਲ ਰਿਹਾ ਸੀ ਸੋ ਫੈਸਟੀਵਲ ਦਿਨਾਂ 'ਤੇ ਕਾਫੀ ਡਿਸਕਾਊਂਟ ਸੀ ਸੋ ਮੈਂ ਸੋਚਿਆ ਬਈ ਹਾਂ ਇਹ ਰਾਈਟ ਬਈ ਠੀਕ ਹੈ ਇਹੀ ਟਾਈਮ ਹੈ ਖਰੀਦਣ ਦਾ ਕਿਉਂਕਿ ਮਾਈਕਰੋਵੇਵ ਸਾਡੇ ਕੋਲ ਪਹਿਲਾਂ ਨਹੀਂ ਸੀ ਅਤੇ ਅਸੀਂ ਫਿਰ ਮੈਂ ਸਿਲੈਕਟ ਕੀਤਾ ਮਾਈਕਰੋਵੇਵ ਅਤੇ ਮੈਨੂੰ ਐਲਜੀ ਦਾ ਵਧੀਆ ਲੱਗਿਆ ਐਨ ਐਲਜੀ 'ਤੇ ਕਾਫੀ ਚੰਗਾ ਡਿਸਕਾਊਂਟ ਸੀ ਸੋ ਮੈਂ ਐ ਉਸ ਤੋਂ ਬਾਅਦ ਮੈਂ ਮੈਂ ਆਰਡਰ ਬੁੱਕ ਕਰਤਾ ਆਪਣਾ ਡਿਲਿਵਰ ਕਰਤਾ ਐਂਡ ਥੋੜ੍ਹੇ ਦਿਨਾਂ ਬਾਅਦ ਮੇਰੇ ਘਰ ਆਰਡਰ ਆ ਗਿਆ ਦੈਨ ਮੈਂ ਬੜਾ ਖੁਸ਼ ਸੀ ਬੀਕੋਜ ਜਦੋਂ ਮੈਂ ਉਹ ਨੂੰ ਓਪਨ ਕੀਤਾ ਦੈਨ ਮੈਨੂੰ ਕਲਰ ਬੜਾ ਵਧੀਆ ਲੱਗਿਆ ਉਹਦਾ ਬੜ੍ਹਾ ਪਸੰਦ ਆਇਆ ਅਤੇ ਫੀ ਫੀਚਰਸ ਬੜ੍ਹੇ ਅੱਛੇ ਸੀ ਐਂਡ ਦੈਨ ਉਸ ਤੋਂ ਬਾਅਦ ਮੈਂ ਆਪਣੀ ਪਤਨੀ ਨੂੰ ਦੱਸਿਆ ਅਤੇ ਐਂਡ ਉਹਨਾਂ ਨੇ ਵੀ ਐਪਰੀਸ਼ੀਏਟ ਕੀਤਾ ਕਿਉਂਕਿ ਡਿਜ਼ਾਈਨ ਬੜਾ ਅੱਛਾ ਲੱਗਿਆ ਉਹਨਾਂ ਨੂੰ ਵੀ ਬਹੁਤ ਅੱਛਾ ਲੱਗਿਆ ਫਿਰ ਉਸ ਤੋਂ ਬਾਅਦ ਮੇਰੀ ਵਾਈਫ ਨੇ ਅ ਪਰੀਪੇਅਰ ਡਿਸ਼ਿਜ਼ ਬਗੈਰਾ ਬਣਾਈਆਂ ਜਿੱਦਾ ਪੀਜ਼ਾ ਬਣਾਇਆ ਸੈਂਡਵਿੱਚਸ ਸੋ ਕਾਫੀ ਅੱਛਾ ਲੱਗਿਆ ਕਾਫੀ ਐਕਪੀਰੀਅਨਸ ਲੱਗਿਆ ਐਂਡ ਮੇਰੇ ਮੇਰੀ ਧੀ ਦਾ ਜਨਮ ਦਿਨ ਸੀ ਅਤੇ ਉਹਨਾਂ ਨੇ ਸਪੈਸ਼ਲ ਕੇਕ ਬਣਾਇਆ ਚੋਕਲੇਟ ਬੀਕੋਜ ਉਹਨਾਂ ਨੂੰ ਬੜਾ ਲਾਈਕ ਕੀਤਾ ਈਵਨ ਸਾਡੇ ਜਿਹੜੇ ਪ੍ਰਾਹੁਣੇ ਆਏ ਸੀ ਉਹਨਾਂ ਨੇ ਵੀ ਈਨਜੋਆਏ ਕੀਤਾ ਕੇਕ ਬੜਾ ਅੱਛਾ ਲੱਗਿਆ ਉਹਨਾਂ ਨੂੰ ਵੀ ਸੋ ਮੈਂ ਆਈ ਥਿੰਕ ਮੇਰੀ ਚੰਗੀ ਡੀਲ ਸੀ ਜਿਹੜੀ ਮੈਂ ਲਿਆ ਪੋਡੈਕਟ